ਬੱਚਿਆਂ ਅਤੇ ਨੌਜਵਾਨਾਂ ਨੂੰ ਸੱਭਿਆਚਾਰਕ ਵਿਕਾਸ ਕਲਾ ਜਾਂ ਸ਼ਿਲਪਕਾਰੀ ਦੀ ਸਿੱਖਿਆ ਇਸ ਕਰਕੇ ਦੇਣੀ ਜ਼ਰੂਰੀ ਆ ਤਾਂ ਕਿ ਉਹ ਆਪਣੇ ਪੁਰਾਤਨ ਸਭਿਅਤਾ ਰੀਤੀ ਰਿਵਾਜਾਂ ਨਾਲ ਜੁੜੇ ਰਹਿਣ ਇਸ ਕਰਕੇ ਜਿਵੇਂ ਕਿ ਕਲਾ ਵਿੱਚ ਸਭ ਤੋਂ ਪਹਿਲਾਂ ਮੈਂ ਲੈਣਾ ਚਾਵਾਂਗੀ ਸੰਗੀਤ ਦੀ ਕਲਾ ਪੁਰਾਤਨ ਸਭਿਅਤਾ ਵਿੱਚ ਮਤਲਬ ਪੰਜਾਬ ਵਿੱਚ ਕਿਸੇ ਵੀ ਵਿਆਹ ਸ਼ਾਦੀ ਦੇ ਮੌਕੇ 'ਤੇ ਸੰਗੀਤ ਦੀ ਬਹੁਤ ਹੀ ਮਹੱਤਵ ਬਹੁਤ ਹੀ ਇਮਪੋਰਟੈਂਸ ਹੁੰਦੀ ਹੈ ਜਿਵੇਂ ਕਿ ਸੰਗੀਤ ਵਿੱਚ ਪਹਿਲਾਂ ਕੁੜੀ ਦੇ ਵਿਆਹ ਤੋਂ ਕੁਛ ਦਿਨ ਪਹਿਲਾਂ ਸੁਹਾਗ ਗਾਇਆ ਜਾਂਦਾ ਸੀ ਇਹ ਸੁਹਾਗ ਗਾਉਣ ਨਾਲ ਮਤਲਬ ਸੁਹਾਗ ਵਿੱਚ ਕੁੜੀ ਦੇ ਮਨ ਦੀ ਜਿਹੜੀ ਸਥਿਤੀ ਹੈ ਉਸ ਵਿੱਚ ਉਸਦੇ ਮਨ ਵਿੱਚ ਜੋ ਚੱਲ ਰਿਹਾ ਉਹਨਾਂ ਨੂੰ ਦਰਸਾਇਆ ਜਾਂਦਾ ਹੈ ਅਤੇ ਕੁੜੀ ਦੇ ਮਨ ਵਿੱਚ ਜਦੋਂ ਉਹ ਸਹੁਰੇ ਘਰ ਤੁਰਦੀ ਹੈ ਉਸ ਦੇ ਮਨ ਵਿੱਚ ਜਿਹੜੀ ਇੱਛਾ ਅਤੇ ਜਿਹੜੀ ਚੇਤਨਾ ਹੁੰਦੀ ਆ ਉਸ ਨੂੰ ਦਰਸਾਉਂਦੇ ਆ ਉਸੇ ਤਰ੍ਹਾਂ ਮੁੰਡੇ ਦੇ ਵਿਆਹ ਵਿੱਚ ਘੋੜੀ ਗਾਇਆ ਜਾਂਦਾ ਸੀ ਜੇ ਜਿਹੜਾ ਕਿ ਮੁੰਡੇ ਦੇ ਘਰਦਿਆਂ ਨੂੰ ਮੁੰਡੇ ਵਾਲਿਆਂ ਨੂੰ ਜਿਹੜੀ ਖੁਸ਼ੀ ਮਹਿਸੂਸ ਹੋ ਰਹੀ ਆ ਉਹਨਾਂ ਨੂੰ ਦਰਸਾਉਂਦਾ ਹੈ ਤਾਂ ਕਰਕੇ ਜਿਹੜਾ ਕਲਾ ਹੈਗਾ ਉਹ ਪੁਰਾ ਪੁਰਾਤਨ ਕਲਾ ਹੈਗੀ ਆ ਉਸ ਦੀ ਸਿੱਖਿਆ ਬੱਚਿਆਂ ਨੂੰ ਦੇਣੀ ਜ਼ਰੂਰੀ ਹੈ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲ ਸਕੇ ਵੀ ਪੁਰਾਤਨ ਸਭਿਅਤਾ ਯਾਂ ਪੁਰਾਣੇ ਸਮੇਂ ਵਿੱਚ ਉਹਨਾਂ ਦੇ ਕਿਹੜੇ ਕਲਾ ਸੀ ਕਿਹੜੀ ਸੰਗੀਤ ਕਲਾ ਸੀ ਦੂਸਰਾ ਜੇਕਰ ਆਪਾਂ ਸ਼ਿਲਪਕਾਰੀ ਦੀ ਗੱਲ ਕਰੀਏ ਤਾਂ ਸ਼ਿਲਪਕਾਰੀ ਦੇ ਤੌਰ 'ਤੇ ਜਿਵੇਂ ਕਿ ਪੰਜਾਬ ਵਿੱਚ ਕਈ ਗੁਰਦੁਆਰੇ ਇਹ ਬਣੇ ਕਈ ਮੰਦਰ ਬਣੇ ਜਿਹਨਾਂ ਵਿੱਚ ਨੀਂਹ ਪੱਥਰਾਂ 'ਤੇ ਗੜੇ ਹੋਏ ਆ ਵੀ ਇਹ ਪੱ ਗੁਰਦੁਆਰਾ ਇਹ ਮੰਦਿਰ ਕਿਸ ਸਮੇਂ ਵਿੱਚ ਬਣਾਇਆ ਗਿਆ ਹੈ ਕਿਸ ਦੁਆਰਾ ਬਣਾਇਆ ਗਿਆ ਅਤੇ ਦੂਸਰਾ ਮਤਲਬ ਆਪਣੇ ਹਿੰਦੂ ਸਭਿਅਤਾ ਨੂੰ ਦੇਖੀਏ ਤਾਂ ਭਾਰਤ ਵਿੱਚ ਕਈ ਥਾਵਾਂ 'ਤੇ ਕਈ ਐਵੇਂ ਦੇ ਮੰਦਰ ਬਣਾ ਇੱਦਾਂ ਦੇ ਮੰਦਰ ਹਨ ਜਿਹਨਾਂ ਵਿੱਚ ਜਿਹੜੀਆਂ ਮੂਰਤੀਆਂ ਹੈਗੀਆਂ ਉਹ ਬਹੁਤ ਹੀ ਅਲੱਗ ਤਰੀਕੇ ਨਾਲ ਬਣਾਈਆਂ ਗਈਆਂ ਹਨ ਜਿਹੜੇ ਕਿ ਆਪਾਂ ਨੂੰ ਸਿੱਧਾ ਦਰਸਾਉਂਦੇ ਹਨ ਕਿ ਪੁਰਾਣੇ ਜ਼ਮਾਨੇ ਦੇ ਲੋਕ ਪੁਰਾਤਨ ਸਭਿਅਤਾ ਦੇ ਲੋਕ ਕਿਸ ਤਰ੍ਹਾਂ ਦੇ ਰਹਿੰਦੇ ਸਨ ਕਿਸ ਤਰ੍ਹਾਂ ਦਾ ਪਹਿਰਾਵਾ ਸੀ ਉਹਨਾਂ ਦਾ ਅਤੇ ਕਿਸ ਤਰ੍ਹਾਂ ਦੀ ਜਿਹੜੀ ਕਈ ਮੰਦਰਾਂ ਦੇ ਦੀਵਾਰਾਂ 'ਤੇ ਉਦ ਉਹਨਾਂ ਦੀ ਕਲਾ ਉਹਨਾਂ ਦੀ ਕਈ ਪੇਂਟਿੰਗ ਚਿੱਤਰ ਵਗੈਰਾ ਇੱਦਾਂ ਦੇ ਬਣਾਏ ਹੋਏ ਹਨ ਜਿਹੜਾ ਕਿ ਆਪਾਂ ਨੂੰ ਦਰਸਾਉਂਦਾ ਵੀ ਪੁਰਾਤਨ ਸਭਿਅਤਾ ਵਿੱਚ ਜਿਹੜੇ ਲੋਕ ਸੀ ਆਪਣੀ ਕਲਾ ਨੂੰ ਕਿਸ ਤਰ੍ਹਾਂ ਬਣਾਉਂਦੇ ਸੀ ਕਲਾ ਲਈ ਆਪਣੀ ਕਲਾ ਨੂੰ ਦਿਖਾਉਣ ਲਈ ਕਿਸ ਚੀਜ਼ਾਂ ਦੀ ਵਰਤਾਂ ਵਰਤੋਂ ਕਰਦੇ ਸੀ ਇਸੇ ਤਰ੍ਹਾਂ ਮਤਲਬ ਜਿਵੇਂ ਕਈ ਮੂਰਤੀਆਂ ਅਤੇ ਕਈ ਮੰਦਰਾਂ ਵਿੱਚ ਉਹ ਪੱਥਰ ਵਰਤੇ ਗਏ ਹਨ ਉਹਨਾਂ ਪੱਥਰਾਂ ਦੀ ਵਰਤੋਂ ਕੀਤੀ ਗਈ ਹੈ ਜਿਹੜੇ ਪੱਥਰ ਕਿ ਬਹੁਤ ਹੀ ਕਈ ਕੀਮਤੀ ਹਨ ਅਤੇ ਉਹ ਚੀਜ਼ਾਂ ਦੀ ਵਰਤੋਂ ਕਰਦੇ ਸਨ ਜੋ ਕਿ ਅੱਜ ਕੱਲ੍ਹ ਬਹੁਤ ਹੀ ਘੱਟ ਪਾਏ ਜਾਂਦੇ ਹਨ ਇਹਨਾਂ ਚੀਜ਼ਾਂ ਨੂੰ ਦੇਖ ਕੇ ਇਹਨਾਂ ਦੀ ਸ਼ਿਲਪਕਾਰੀਆਂ ਨੂੰ ਦੇਖ ਕੇ ਅਤੇ ਗਿਆਨ ਵੀ ਹੈਰਾਨ ਹੁੰਦਾ ਹੈ ਵੀ ਪੁਰਾਤਨ ਸੱਭਿਅਤਾ ਦੇ ਪੁਰਾਣੇ ਜ਼ਮਾਨੇ ਦੇ ਲੋਕ ਇੰਨੀ ਆਧੁਨਿਕ ਸੋਚ ਰੱਖਦੇ ਸੀ ਇੰਨੀ ਮਾਡਰਨ ਸੋਚ ਰੱਖਦੇ ਸੀ ਪਰ ਹੁਣ ਇਹ ਗਾਇਬ ਹੋ ਗਈ ਆ ਪਤਾ ਨਹੀਂ ਕਿਸ ਤਰ੍ਹਾਂ ਬਟ ਹਾਲੇ ਵੀ ਪਰ ਹਲੇ ਵੀ ਉਸ ਤਰ੍ਹਾਂ ਦੀ ਸੋਚ ਉਸ ਤਰ੍ਹਾਂ ਦੀ ਕਲਾ ਨੂੰ ਕੋਈ ਨਹੀਂ ਪਾ ਸਕਿਆ ਸੋ ਇਸ ਕਰਕੇ ਆਪਾਂ ਨੂੰ ਬੱਚਿਆਂ ਨੂੰ ਆਪਣੇ ਸੱਭਿਆਚਾਰ ਅਤੇ ਆਪਣੀ ਕਲਾ ਬਾਰੇ ਦੱਸਦੇ ਰਹਿਣਾ ਚਾਹੀਦਾ ਹੈ ਧੰਨਵਾਦ